ਰੇਲ ਗੱਡੀ ਦਾ ਸਫਰ ਬਹੁਤ ਰੋਂਮਾਚਕ ਹੁੰਦਾ ਹੈ ਇਹ ਸਾਰ ਸਾਰੇ ਦੇਸ਼ ਨੂੰ ਇੱਕ ਦੂਜੇ ਨਾਲ ਜੋੜਦਾ ਹੈ ਜਿਵੇਂ ਕਿ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਇਹ ਇੱਕ ਬਹੁਤ ਲੰਬਾ ਬੜਾ ਰੇਲਵੇ ਸਫਰ ਹੈ ਜਿਸ ਦੇ ਵਿੱਚ ਕੁੱਲ ਤਿੰਨ ਦਿਨਾਂ ਦਾ ਸਫ਼ਰ ਹੁੰਦਾ ਹੈ ਜ ਅਤੇ ਜਿਸ ਦੇ ਵਿੱਚ ਆਪਾਂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਫਰ ਕਰਦੇ ਹਨ ਅਤੇ ਅੱਜ ਦੇ ਘੜੀ ਦੇ ਵਿੱਚ ਭਾਰਤ ਲਵੇ ਬਹੁਤ ਸਾਰੇ ਇੰਜਨ ਹਨ ਜਿਵੇਂ ਕਿ ਡੀਜ਼ਲ ਇੰਜਨ ਹਾਈਬ੍ਰਿਡ ਇੰਜਨ ਅਤੇ ਇਲੈਕਟਰਿਕ ਇੰਜਨ ਬਟ ਅੱਜ ਦੇ ਸਮੇਂ ਦੇ ਵਿੱਚ ਇਲੈਕਟਰਿਕ ਇੰਜਨ ਦੀ ਵਰਤੋਂ ਵੱਧ ਤੋਂ ਵੱਧ ਹੋ ਰਹੀ ਹੈ ਅਤੇ ਇ ਇਹ ਇਸ ਦੀ ਦੇ ਨਾਲ ਪ੍ਰਦੂਸ਼ਣ ਵੀ ਬਹੁਤ ਜ਼ਿਆਦਾ ਘੱਟ ਰਿਹਾ ਹੈ ਮੈਂ ਆਪਣੇ ਇੱਕ ਰੇਲ ਗੱਡੀ ਦੇ ਸਫਰ ਬਾਰੇ ਬਿਆਨ ਵੀ ਕਰ ਰਿਹਾ ਹਾਂ ਜੋ ਕਿ ਮੇਰਾ ਸਕੂਲ ਦਾ ਟਰਿਪ ਜਿਹੜਾ ਮੈਨੂੰ ਦਸਵੀਂ ਕਲਾਸ ਦੇ ਵਿੱਚ ਡਾਰਜਲਿੰਗ ਲੈ ਕੇ ਗਿਆ ਸੀ ਜਿੱਥੇ ਅਸੀਂ ਦਸ ਦਿਨਾਂ ਦਾ ਟਰਿਪ ਸੀ ਜਿਸ ਦੇ ਵਿੱਚ ਅਸੀਂ ਚੰਡੀਗੜ੍ਹੋਂ ਆਪਣੀ ਟ੍ਰੇਨ ਫੜੀ ਜਿੱਥੇ ਉਹ ਸਾਨੂੰ ਵੈਸਟ ਬੰਗਾਲ ਤੱਕ ਲੈ ਕੇ ਗਈ ਇਹ ਸਫਰ ਕੁੱਲ ਤਿੰਨ ਦਿਨਾਂ ਦਾ ਸੀ ਜਦੋਂ ਅਸੀਂ ਟ੍ਰੇਨ ਦੇ ਵਿੱਚ ਬੈਠੇ ਸਾਨੂੰ ਬੜਾ ਰੋਮਾਂਚਿਕ ਫੀਲ ਹੋ ਰਿਹਾ ਸੀ ਕਿਉਂਕਿ ਰੇਲ ਗੱਡੀ ਪਟਰੀ ਦੇ ਉੱਤੇ ਜਦੋਂ ਚੱਲ ਰਹੀ ਸੀ ਤਾਂ ਸਾਡੇ ਡੱਬਾ ਵੀ ਹਿਲ ਰਿਹਾ ਸੀ ਅਤੇ ਸਾਡੇ ਰੇਲ ਗੱਡੀ ਦੇ ਵਿੱਚ ਡੱਬਾ ਏਸੀ ਸਲਿੱਪਰ ਦਾ ਸੀ ਜਿਸ ਦੇ ਵਿੱਚ ਅਸੀਂ ਤਿੰਨ ਬੈਡ ਇੱਕ ਪਾਸੇ ਤਿੰਨ ਬੈਡ ਇੱਕ ਪਾਸੇ ਲੱਗੇ ਹੋਏ ਸੀਗੇ ਜਿਹਦੇ ਵਿੱਚ ਲੋਅਰ ਮਿਡਲ ਅਤੇ ਅਪਰ ਕੇਸ ਹੁੰਦੇ ਸੀਗੇ ਅਤੇ ਇਸ ਦੇ ਨਾਲ ਸਾਨੂੰ ਤਿੰਨ ਦਿਨ ਦਾ ਸਫਰ ਬਹੁਤ ਰੋਮਾਂਚਿਕ ਰਿਹਾ ਬਟ ਪਰ ਉਸਦਾ ਖਾਣਾ ਥੋੜ੍ਹਾ ਸਾਦਾ ਹੀ ਰਿਹਾ ਕਿ ਖਾਣੇ ਕਰਕੇ ਸਾਨੂੰ ਕਾਫੀ ਜ਼ਿਆਦਾ ਤਕਲੀਫਾਂ ਹੋਈਆਂ ਇਸ ਬਟ ਉਸ ਤੋਂ ਇਲਾਵਾ ਸਾਡਾ ਰੇਲ ਗੱਡੀ ਦਾ ਸਫਰ ਬਹੁਤ ਵਧੀਆ ਰਿਹਾ ਅਤੇ ਇਸ ਕਰਕੇ ਸਾਨੂੰ ਰੇਲ ਗ ਮੈਨੂੰ ਰੇਲ ਗੱਡੀ ਦਾ ਸਫਰ ਬਹੁਤ ਵਧੀਆ ਲੱਗਦਾ ਹੈ ਅਤੇ ਜੇ ਇਲੈਕਟਰਿਕ ਗੱਡੀ ਰੇਲ ਗੱਡੀਆ ਤਾਂ ਗੱਲ ਕਰੀਏ ਤਾਂ ਉਹਨਾਂ ਦਾ ਕੋਈ ਸ਼ੋਰ ਸ਼ਰਾਬਾ ਨਹੀਂ ਹੁੰਦਾ ਪਰ ਡੀਜ਼ਲ ਗੱਡੀ ਦਾ ਰੇਲ ਗੱਡੀ ਦਾ ਬਹੁਤ ਜ਼ਿਆਦਾ ਸ਼ੋਰ ਸ਼ਰਾਬਾ ਹੁੰਦਾ ਪਰ ਅੱਜ ਦੀ ਸਰਕਾਰ ਰੇ ਇਲੈਕਟਰਿਕ ਇੰਜਨਾਂ ਨੂੰ ਜ਼ਿਆਦਾ ਤਵੱਜੋ ਦੇ ਰਹੀ ਹੈ ਅਤੇ ਡੀਜ਼ਲ ਇੰਜਨਾਂ ਨੂੰ ਘੱਟੋ ਘੱਟ ਕਰ ਰਹੀ ਹੈ ਬਟ ਹ ਆਉਣ ਵਾਲੇ ਸਮੇਂ ਦੇ ਵਿੱਚ ਡੀਜ਼ਲ ਇੰਜਨ ਬਿਲਕੁਲ ਹੀ ਖਤਮ ਕਰ ਦਿੱਤੇ ਜਾਣਗੇ ਅਤੇ ਇਲੈਕਟਰਿਕ ਇੰਜਨ ਜਾਂ ਫਿਰ ਹਾਈਬ੍ਰਿਡ ਇੰਜਨ ਦਾ ਵਰਤੋਂ ਕੀਤੀ ਜਾਵੇਗੀ ਅਤੇ ਆਪਣੇ ਸਾਇੰਟਿਸਟ ਪਾਣੀ 'ਤੇ ਚੱਲਣ ਵਾਲਾ ਰੇਲ ਗੱਡੀ ਵੀ ਲ ਇੰਜਨ ਲੱਭ ਰਹੇ ਹਨ ਅਤੇ ਹਾਣ ਵਾਲੇ ਸਮੇਂ ਦੇ ਵਿੱਚ ਆਪਣੀ ਰੇਲ ਗੱਡੀਆਂ ਪਾਣੀ 'ਤੇ ਵੀ ਚ ਪਾਣੀ ਦੇ ਨਾਲ ਵੀ ਚੱਲ ਸਕਦੀਆਂ ਹਨ ਅਤੇ ਇਹ ਆਪਣਾ ਪ੍ਰਦੂਸ਼ਣ ਘੱਟੋ ਘੱਟ ਕਰੇਗੀ ਅਤੇ ਆਪਣਾ ਦੇਸ਼ ਨੂੰ ਵਿਕਾਸ ਕਰਨ ਲਈ ਵੀ ਮਦਦ ਕਰਨ ਕਿਰਿਆ ਹਨ ਅਤੇ ਵਰਤ ਵੰਦੇ ਭਾਰਤ ਇਸ ਦੀ ਇੱਕ ਸ਼ੁਰੂਆਤੀ ਸਟੇਜ ਹੈ ਜਿਹਦੇ ਵਿੱਚ ਕੀ ਹੈ ਕਿ ਸਰਕਾਰ ਨੇ ਇਲੈਕਟ੍ਰਿਕ ਇੰਜਨ ਦੀ ਵਰਤੋਂ ਦੇ ਨਾਲ ਆਪਣਾ ਇੰਜਨ ਸ ਬਣਾਇਆ ਅਤੇ ਉਹ ਟ੍ਰੇਨ ਬਹੁਤ ਵਧੀਆ ਚੱਲ ਰਹੀਆਂ ਹਨ ਜਿਵੇਂ ਕਿ ਹੁਣ ਦਿੱਲੀ ਨੂੰ ਪੰਜ ਦਿੱਲੀ ਤੋਂ ਚੰਡੀਗੜ੍ਹ ਉਹ ਚੱਲੇਗੀ ਅਤੇ ਉਸਦਾ ਉਦਘਾਟਨ ਵੀ ਹੋ ਚੁੱਕਿਆ ਹੈ